ਅਕਸਰ ਜਦੋਂ ਅਸੀਂ ਕਦੇ ਕਿਸੇ ਨਾਲ ਕੰਮ ਕਰਦੇ ਹੁੰਦੇ ਹਾਂ ਅਤੇ ਉਸ ਵਿਅਕਤੀ ਨੂੰ ਮਿਲਣਾ ਮੁਸ਼ਕਲ ਹੋ ਜਾਵੇ ਤਾਂ ਸਾਨੂੰ ਬੜਾ ਹੀ ਔਖਾ ਲੱਗਦਾ ਹੈ ਉਸ ਸਥਿਤੀ ਨੂੰ ਸੁਲਝਾਉਣਾ ਅਤੇ ਮੈਂ ਇੱਕ ਵਾਰ ਦੀ ਗੱਲ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਔਫਿਸ ਦੇ ਵਿੱਚ ਕੰਮ ਕਰਦੇ ਹਾਂ ਅਤੇ ਕਈ ਵਾਰ ਸਾਡੇ ਜਿਹੜੇ ਸੀਨੀਅਰ ਨੇ ਸਾਡੇ ਸ ਸਰ ਨੇ ਉਹ ਫੋਰਨ ਦੇ ਵਿੱਚ ਜਾਂ ਕਿਤੇ ਹੋਰ ਕ ਦੂਸਰੇ ਦੇਸ਼ ਵਿਦੇਸ਼ ਵਿੱਚ ਚਲੇ ਜਾਂਦੇ ਨੇ ਤਾਂ ਕੰਮ ਤਾਂ ਉਹਨਾਂ ਨਾਲ ਕਰਦੇ ਹਾਂ ਉਹਨਾਂ ਤੋਂ ਬਿਨਾਂ ਪੁੱਛੇ ਅਸੀਂ ਕੁਝ ਕਰ ਵੀ ਨਹੀਂ ਸਕਦੇ ਤਾਂ ਉਸ ਕੇਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਉਹਨਾਂ ਨੂੰ ਸੰਪਰਕ ਕਰਦੇ ਹਾਂ ਟੈਲੀਫੋਨ ਰਾਹੀਂ ਅਤੇ ਜਿਹੜੀ ਵੀ ਪ੍ਰੋਬਲਮ ਹੈ ਅਸੀਂ ਫੋਨ ਰਾਹੀਂ ਸਭ ਕੁਛ ਆਪਸ 'ਚ ਸੰਪਰਕ ਰਾਹੀਂ ਡਿਸਕਸ਼ਨ ਕਰਕੇ ਉਹਨਾਂ ਨੂੰ ਸੁਲਝਾ ਲੈਂਦੇ ਹਾਂ ਆਪਣੀ ਮੁਸ਼ਕਲ ਨੂੰ